ਤੁਸੀਂ ਗੋਇਲ ਅਜੈਂਸੀ ਤੋਂ ਬੋਲਦੇ ਹੋ ਮੈਂ ਕੁਝ ਦਿਨ ਪਹਿਲਾਂ ਅੱਜ ਦੇ ਦਿਨ ਵਾਸਤੇ ਕੈਬ ਬੁੱਕ ਕੀਤੀ ਸੀ ਅਤੇ ਅਸੀਂ ਅੰਮ੍ਰਿਤਸਰ ਮੈਂ ਆਪਣੇ ਸਾਰੇ ਪਰਿਵਾਰ ਨਾਲ ਘੁੰਮਣ ਜਾਣਾ ਸੀ ਅਤੇ ਜਿਸ ਕਰਕੇ ਤੁਹਾਡਾ ਡਰੈਵਰ ਨੂੰ ਸਮਾਂ ਦਿੱਤਾ ਸੀ ਜੋ ਸਮਾਂ ਦਿੱਤਾ ਸੀ ਉਹ ਸਮੇਂ 'ਤੇ ਤੁਹਾਡਾ ਡਰੈਵਰ ਨਹੀਂ ਆਇਆ ਤਾਂ ਮੈਂ ਇਸ ਕਰਕੇ ਮੈਂ ਉਸ ਕੈਬ ਨੂੰ ਕੈਂਸਲ ਕਰਦੀ ਹਾਂ ਕਿਉਂਕਿ ਤੁਹਾਨੂੰ ਵੀ ਪਤਾ ਅੰਮ੍ਰਿਤਸਰ ਜਾਣ 'ਚ ਦੋ ਤਿੰਨ ਘੰਟੇ ਜਾਣ 'ਚ ਵੀ ਲੱਗਦੇ ਅਤੇ ਦੋ ਤਿੰਨ ਘੰਟੇ ਆਉਣ 'ਚ ਵਾ ਲੱਗਦੇ ਹੈ ਅਤੇ ਵਾਪਸੀ ਵੀ ਔ ਅਸੀਂ ਆਉਣਾ ਵੀ ਸੀ ਅਤੇ ਅੱਜ ਦੇ ਦਿਨ ਵਾਪਿਸ ਵੀ ਆਉਣਾ ਸੀ ਅਤੇ ਉਹ ਤੁਹਾਡਾ ਡਰੈਵਰ ਸਮੇਂ 'ਤੇ ਪੰਹੁਚਿਆ ਨਹੀਂ ਉਸ ਟੈਮ 'ਤੇ ਆਇਆ ਨੀਗਾ ਅਤੇ ਮੈਂ ਕਿਵੇਂ ਫਿਰ ਤੁਹਾਡੀ ਕੈਬ ਮੈਂ ਕੈਂਸਲ ਕਰ ਦਿੱਤੀ ਹੈ ਅਤੇ ਤੁਹਾਡਾ ਕੈਬ ਮੈਨੂੰ ਇਹ ਤੁਹਾਡਾ ਕੰਮ ਜਮਾਂ ਨਹੀਂ ਚੰਗਾ ਲੱਗਿਆ ਕਿ ਤੁਸੀਂ ਸਮੇਂ 'ਤੇ ਤੁਹਾਡਾ ਕੋਈ ਵੀ ਡਰੈਵਰ ਸਾਡੇ ਕੰਮ ਨਹੀਂ ਆ ਸਕਿਆ ਅਸੀਂ ਘੁੰਮਣ ਤੋਂ ਵੀ ਰਹਿ ਗਏ ਹਾਂ ਅਸੀਂ ਜਾ ਨਹੀਂ ਸਕੇ ਗੇ ਅਤੇ ਇਸ ਕਰਕੇ ਮੈਂ ਤੁਹਾਡੀ ਕੈਬ ਕੈਂਸਲ ਕਰ ਦਿੱਤੀ ਅਸੀਂ ਘੁੰਮਣ ਜਾਣ ਦਾ ਵੀ ਪ੍ਰੋਗਰਾਮ ਕੈਂਸਲ ਕਰ ਦਿੱਤਾ